ਹਾਂਜੀ ਹਾਂਜੀ ਬੋਲੀਏ ਹੈਲ ਹਾਂਜੀ ਹਾਂਜੀ ਬੋਲੋ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਅੰਮ੍ਰਿਤਸਰ ਦੇ ਲਾਗੇ ਜਿਵੇਂ ਬਾਹਰ ਨਿਕਲੋਂ ਅੰਮ੍ਰਿਤਸਰ ਤੋਂ ਬਹੁਤ ਸਾਰੇ ਹਿਲ ਸਟੇਸ਼ਨ ਹੈਗੇ ਆ ਜਿਵੇਂ ਜੰਮੂ ਕਸ਼ਮੀਰ ਹਿਮਾਚਲ ਹੋਰ ਹਰਿਆਣੇ ਹੁਸ਼ਿਆਰਪੁਰ ਬਹੁਤ ਸਾਰੇ ਹੈ ਹਿਲ ਸਟੇਸ਼ਨ ਅਤੇ ਉੱਥੇ ਜਾ ਕੇ ਘੁੰਮੋ ਜੰਮੂ ਕਸ਼ਮੀਰ ਜਾਓ ਉੱਥੋਂ ਦੀਆਂ ਪਹਾੜੀਆਂ ਵੇਖੋ ਵਧੀਆ ਵਧੀਆ ਹਵਾਵਾਂ ਵੇਖੋ ਸ਼ੁੱਧ ਹਵਾ ਲਓ ਹਾਂਜੀ ਉੱਥੋਂ ਦਾ ਵਾਤਾਵਰਨ ਬਹੁਤ ਵਧੀਆ ਸ਼ੁੱਧ ਹੈਗਾ ਵਾ ਵੈਸੇ ਨਾ ਤੁਸੀਂ ਜੰਮੂ ਕਸ਼ਮੀਰ ਜਾਓ ਗਰਮੀਆਂ ਦੇ ਮੌਸਮ 'ਚ ਉੱਥੋਂ ਦੀ ਬਹੁਤ ਠੰਡੀ ਹਵਾਵਾਂ ਬਹੁਤ ਵਧੀਆ ਹੈਗਾ ਏ ਜੀ ਨਹੀਂ ਨਹੀਂ ਹੁਣ ਵੀ ਜਾਓ ਹੁਣ ਕਿਉਂ ਨਾ ਜਾਈਏ ਹੁਣ ਵੀ ਜਾਓ ਤੁਸੀਂ ਹੁਣ ਵੀ ਤੁਹਾਡੇ ਲਈ ਜਾਣਾ ਵਧੀਆ ਹੈਗਾ ਹੈ ਠੰਡ ਵਿੱਚ ਜਾਓਗੇ ਅਤੇ ਉੱਥੇ ਉਹ ਹੋ ਜਾਣਾ ਜਾਮ ਹੋ ਜਾਣਾ ਬਰਫ਼ਾਂ ਨਾਲ ਚਲੋ ਜੀ ਸਭ ਕਿਤੇ ਘੁੰਮੋ ਫਿਰੋ ਬਹੁਤ ਵਧੀਆ ਜਗ੍ਹਾ ਹੈਗੀਆਂ ਓਕੇ ਜੀ ਓਕੇ ਜੀ ਓਕੇ ਹਾਂਜੀ ਹਾਂਜੀ ਲੋੜ ਹੋਏਗੀ ਤੁਸੀਂ ਫ਼ੋਨ ਕਰਕੇ ਜਦੋਂ ਮਰਜ਼ੀ ਪੁੱਛ ਸਕਦੇ ਹੋ ਜੀ